ਉੱਥੇ ਵੀ ਕਈ ਵਾਰੀ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਹਨ ਚਾਲਕ ਕਹਿਣਗੇ ਕਿ ਤੁਸੀਂ ਕਿਵੇਂ ਇਹ ਫੋਟੋਆਂ ਕਿਵੇਂ ਖਿੱਚ ਰਹੇ ਹੋ ਤੁਸੀਂ ਨਹੀਂ ਖਿੱਚ ਸਕਦੇ ਫਿਰ ਕਈ ਵਾਰੀ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਸਾਨੂੰ ਆਪਣੇ ਆਈਡੈਂਟੀ ਕਾਰਡ ਵਗੈਰਾ ਵੀ ਦੱਸਣੇ ਪੈ ਜਾਂਦੇ ਵੀ ਅਸੀਂ ਪੱਤਰਕਾਰ ਹੈ ਅਤੇ ਇਸ ਤਰ੍ਹਾਂ ਫੀਲਡ ਵਿੱਚ ਬਹੁਤ ਵਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ